ਬਰਤਨ ਧੋਣ ਤੋਂ ਪਹਿਲਾਂ ਸਾਰੇ ਬਰਤਨਾਂ ਨੂੰ ਸਿੰਕ ਵਿੱਚ ਇਕੱਠਾ ਕੀਤਾ ਜਾਂਦਾ ਫਿਰ ਅਲੱਗ ਅਲੱਗ ਭਾਂਡਿਆਂ ਨੂੰ ਪਲੇਟਾਂ ਚਮਚ ਗਲਾਸ ਕੌਲੀਆਂ ਨੂੰ ਅਲੱਗ ਅਲੱਗ ਕਰਕੇ ਰੱਖਿਆ ਜਾਂਦਾ ਵੱਡੇ ਵੱਡੇ ਭਾਂਡਿਆਂ ਨੂੰ ਇੱਕ ਪਾਸੇ ਰੱਖਿਆ ਜਾਂਦਾ ਬਰਤਨ ਧੋਣ ਤੋਂ ਪਹਿਲਾਂ ਉਹਨਾਂ ਤੋਂ ਜੂਠ ਸਾਫ਼ ਕੀਤੀ ਜਾਂਦੀ ਹੈ ਜਿਨ੍ਹਾਂ ਭਾਂਡਿਆਂ ਨੂੰ ਤੇਲ ਵਗੈਰਾ ਜਾਂ ਚਿਕਨਾਹਟ ਲੱਗੀ ਹੁੰਦੀ ਹੈ ਉਹਨਾਂ ਨੂੰ ਅੱਡ ਕਰਕੇ ਥੋੜ੍ਹੇ ਜਿਹੇ ਗਰਮ ਪਾਣੀ ਨਾਲ਼ ਧੋਤਾ ਜਾਂਦਾ ਤਾਂ ਜੋ ਉਹਨਾਂ ਨੂੰ ਸੌਖਿਆਂ ਮਾਂਜਿਆ ਜਾ ਸਕੇ ਮੈਂ ਤੇਲ ਵਾਲੇ ਬਰਤਨਾਂ ਨੂੰ ਧੋਣ ਲਈ ਗਰਮ ਪਾਣੀ ਅਤੇ ਲੀਸਾ ਪੋਲ ਦੀ ਮਦਦ ਨਾਲ਼ ਸਾਫ਼ ਕਰਦੀ ਹਾਂ ਤਾਜ ਕੰਪਨੀ ਦਾ ਲੀਸਾ ਪੋਲ ਜਿਸਨੂੰ ਘਰ ਵਿੱਚ ਹੀ ਆਸਾਨੀ ਨਾਲ਼ ਬਣਾਇਆ ਜਾ ਸਕਦਾ ਹੈ ਉਸ ਦੀ ਵਰਤੋਂ ਨਾਲ਼ ਬਰਤਨ ਬਹੁਤ ਨਿਖਰਦੇ ਹਨ ਅਤੇ ਭਾਂਡੇ ਭਾਂਡਿਆਂ 'ਤੇ ਅਲੱਗ ਹੀ ਚਮਕ ਆ ਜਾਂਦੀ ਹੈ ਜੇ ਕਈ ਵਾਰ ਲੀਸਾ ਪੋਲ ਨਾ ਹੋਵੇ ਤਾਂ ਮੈਂ ਵਿੰਮ ਲਿਕੁਏਡ ਨੂੰ ਗਰਮ ਪਾਣੀ ਵਿੱਚ ਮਿਕਸ ਕਰਕੇ ਉਸਦਾ ਇਸਤੇਮਾਲ ਕਰਦੀ ਹਾਂ ਕਦੀ ਕਦੀ ਪਤੰਜਲੀ ਡਿਸ਼ ਬਾਰ ਦੀ ਵੀ ਵਰਤੋਂ ਕਰਦੀ ਹਾਂ ਫਿਰ ਵੀ ਜੇ ਕੋਈ ਦਾਗ ਨਾ ਉਤਰੇ ਤਾਂ ਬੇਕਿੰਗ ਸੋਡਾ ਸਿਰਕਾ ਨਿੰਬੂ ਅਤੇ ਨਮਕ ਪਾ ਕੇ ਉਸਨੂੰ ਮਿਕਸ ਕਰਕੇ ਉਸ ਬਰਤਨ ਨੂੰ ਸਾਫ਼ ਕਰਦੀ ਹਾਂ ਇਸ ਤਰ੍ਹਾਂ ਕਰਨ ਨਾਲ਼ ਬਰਤਨ ਵਧੀਆ ਸਾਫ਼ ਹੋ ਜਾਂਦਾ ਹੈ ਅਤੇ ਉਸ 'ਤੇ ਚਮਕ ਵੀ ਆ ਜਾਂਦੀ ਹੈ ਅਤੇ ਉਸ ਵਿੱਚੋਂ ਆਉਂਦੀ ਕਿਸੇ ਵੀ ਤਰ੍ਹਾਂ ਦੀ ਸਮੈਲ ਉਹ ਵੀ ਦੂਰ ਹੋ ਜਾਂਦੀ ਹੈ